ਜਿਵੇਂ ਕਿ ਮੈਂ ਕਿਤੇ ਕੋਈ ਦੂਰ ਬੈਠਾ ਹੈ ਉਹਨੂੰ ਫੋਨ ਦੇਣ ਫੋਨ ਕ 'ਤੇ ਮੈਂ ਵੀਡੀਓ ਕੋਲਿੰਗ ਕਰ ਸਕਦੀ ਹਾਂ ਜਿਵੇਂ ਮੈਨੂੰ ਕੋਈ ਗੱਲ ਕਰਨਾ ਹੈ ਤਾਂ ਮੈਂ ਚੈਟਿੰਗ ਦੇ ਰਾਹੀਂ ਗੱਲ ਕਰ ਸਕਦੀ ਹਾਂ ਅਤੇ ਮੈਂ ਕੋਈ ਵੀ ਫੋਨ ਫੋਨ ਦਾ ਇੱਕ ਜੀਵਨ ਵਿੱਚ ਸਾਡੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ ਅਤੇ ਅੱਜ ਕੱਲ੍ਹ ਦੇ ਸਮੇਂ ਵੀ ਇੱਦਾਂ ਕੋਈ ਵੀ ਨਹੀਂ ਹੋਉਗਾ ਕਿ ਕਿਸੇ ਕੋਲ ਫੋਨ ਨਾ ਹੋਏ ਅਤੇ ਫੋਨ